ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਨਾ ਤੁਹਾਡੀ ਐਪ ਤੋਂ ਕੁਛ ਸਮਾਨ ਮੰਗਵਾਇਆ ਸੀ ਜਿਸ ਦੀ ਮੈਨੂੰ ਬਹੁਤ ਜ਼ਰੂਰਤ ਸੀ ਅਤੇ ਸਮਾਨ ਵੀ ਕੁਛ ਕਾਫ਼ੀ ਜ਼ਿਆਦਾ ਸੀ ਅਤੇ ਐਕਚੁਲੀ ਗੱਲ ਇਸ ਤਰ੍ਹਾਂ ਕਿ ਉਹ ਮੇਰੀ ਨਾ ਫਰੈਂਡ ਨੇ ਸਮਾਨ ਮੈਨੂੰ ਮੰਗਵਾ ਤਾ ਅਤੇ ਇਸ ਕਰਕੇ ਮੈਂ ਤੁਹਾਡੇ ਐਪ ਤੋਂ ਉਹ ਆਪਣਾ ਔਡਰ ਜਿਹੜਾ ਸੀ ਉਹ ਕੈਂਸਲ ਕਰਤਾ ਸੀ ਅਤੇ ਲੇਕਿਨ ਜੋ ਮੇਰਾ ਅਮਾਊਂਟ ਸੀ ਪੈਸੇ ਸੀ ਮੇਰੇ ਲੇਕਿਨ ਉਹ ਰਿਫੰਡ ਅੱਜ ਤੱਕ ਨਹੀਂ ਹੋਏ ਆ ਤੁਹਾਡੀ ਐਪ ਦਾ ਅੱਜ ਤੱਕ ਰਿਸਪੋਂਸ ਬਹੁਤ ਵਧੀਆ ਰਿਹਾ ਮੈਂ ਬਹੁਤ ਹੀ ਯੂਜ ਕਰਦੀ ਹਾਂ ਇਹ ਐਪ ਅਤੇ ਮੈਂ ਕਾਫ਼ੀ ਜ਼ਿਆਦਾ ਸਮਾਨ ਮੰਗਵਾਇਆ ਸੀ ਤੁਹਾਡੀ ਐਪ ਤੋਂ ਅਤੇ ਹਮੇਸ਼ਾ ਟਾਈਮ 'ਤੇ ਬਿਲਕੁਲ ਪਹੁੰਚਦਾ ਰਿਹਾ ਹੈ ਅਤੇ ਜਦੋਂ ਵੀ ਮੀਨਜ਼ ਅਸੀਂ ਕੋਈ ਔਡਰ ਕੈਂਸਲ ਕੀਤਾ ਹੈ ਤਾਂ ਰਿਫੰਡ ਵੀ ਸਾਨੂੰ ਬਹੁਤ ਜਲਦੀ ਪਹੁੰਚਿਆ ਅਤੇ ਇਸ ਕਰਕੇ ਮੈਨੂੰ ਜ਼ਿਆਦਾ ਜਲਦੀ ਹੋਣ ਕਰਕੇ ਤਾਂ ਮੈਂ ਆਪਣੀ ਫਰੈਂਡ ਨੂੰ ਨੂੰ ਕਹਿਤਾ ਸੀ ਅਤੇ ਉਹਨੇ ਮੇਰਾ ਸਮਾਨ ਮੰਗਵਾਤਾ ਸੀ ਉਹਨੇ ਵੀ ਕੁਛ ਮੰਗਵਾਉਣਾ ਸੀ ਅਤੇ ਇਸ ਕਰਕੇ ਮੈਨੂੰ ਆਪਣਾ ਜਿਹੜਾ ਔਡਰ ਮੈਂ ਤੁਹਾਡੀ ਐਪ ਦਿੱਤਾ ਸੀ ਤਾਂ ਉਹ ਫਿਰ ਮੈਨੂੰ ਕੈਂਸਲ ਕਰਨਾ ਪਿਆ ਅਤੇ ਮਕਾ ਪਹਿਲਾਂ ਵੀ ਰਿਕੁਐਸਟ ਕਰ ਚੁੱਕੀ ਹਾਂ ਕਿ ਮੇਰਾ ਜਿਹੜਾ ਪੈਸੇ ਸੀ ਮੇਰੇ ਉਹ ਮੈਨੂੰ ਰਿਫੰਡ ਕਰ ਦਿੱਤੇ ਜਾਣ ਅਤੇ ਲੇਕਿਨ ਰਿਫੰਡ ਨਹੀਂ ਹੋਏ ਤਾਂ ਮੈਂ ਬਹੁਤ ਧੰਨਵਾਦੀ ਹੋਵਾਂਗੀ ਅਗਰ ਤੁਸੀਂ ਮੇਰੇ ਪੈਸੇ ਜਲਦ ਤੋਂ ਜਲਦ ਰਿਫੰਡ ਕਰ ਦਵੋ ਤਾਂ ਕਿ ਮੇਰਾ ਆਉਣ ਵਾਲੇ ਸਮੇਂ 'ਚ ਵੀ ਤੁਹਾਡੀ ਐਪ ਦੇ ਨਾਲ ਚੰਗਾ ਲੈਣ ਦੇਣ ਬਣਿਆ ਰਹੇ ਅਤੇ ਜੋ ਵਿਸ਼ਵਾਸ ਮੀਨਜ਼ ਪਹਿਲਾਂ ਦਾ ਕਾਇਮ ਹੈ ਤੁਹਾਡੀ ਐਪ 'ਤੇ ਅਤੇ ਅਸੀਂ ਸਮਾਨ ਵੱਲੋ ਵੀ ਕਾਫ਼ੀ ਸੰਤੁਸ਼ਟ ਹੁੰਦੇ ਹਾਂ ਚੰਗਾ ਸਮਾਨ ਮਿਲਦਾ ਹੈ ਅਤੇ ਟਾਈਮ 'ਤੇ ਡਿਲੀਵਰੀ ਹੁੰਦੀ ਆ ਕੋਈ ਦਿੱਕਤ ਨਹੀਂ ਹੁੰਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਇਸ ਵਾਰ ਸਿਰਫ਼ ਇੱਕ ਥੋੜ੍ਹੀ ਜਿਹੀ ਸਮੱਸਿਆ ਦਾ ਕਰਕੇ ਮੈਂ ਸਮਾਨ ਕਿਸੇ ਹੋਰ ਕੋਲੋਂ ਮੰਗਵਾਉਣਾ ਪਿਆ ਅਤੇ ਇਸ ਕਰਕੇ ਮੈਂ ਤੁਹਾਡੇ ਰਿਕੁਐਸਟ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਰਾ ਰਿਫੰਡ ਕਰ ਦਿਓ